ਮੇਰੇ ਪਿੰਡ ਦੇ ਸਕੂਲ ਵਿੱਚ ਸਾਫ਼ ਪੀਣ ਦਾ ਪਾਣੀ ਪੜ੍ਹਾਈ ਦੀਆਂ ਕਿਤਾਬਾਂ ਅਤੇ ਕੁਝ ਬੁਨਿਆਦੀ ਸਿੱਖਣ ਦੇ ਸਮਾਗਰ ਹਨ ਪਰ ਕਦੇ ਕਦੇ ਪਾਣੀ ਦੀ ਗੁਣਵੱਤਾ ਠੀਕ ਨਹੀਂ ਹੁੰਦੀ ਅਤੇ ਕਿਤਾਬਾਂ ਦੀਆਂ ਪਰਚੇਜ਼ ਹੋ ਜਾਂਦੀਆਂ ਹਨ ਕਈ ਵਾਰ ਅਸੀਂ ਸਿਖਲਾਈ ਮਾਲ ਨੂੰ ਲੈ ਕੇ ਕੁਝ ਸਮੱਸਿਆਵਾਂ ਦੀ ਮੁੱਦਾਂ ਕਰਦੇ ਹਾਂ ਜਦੋਂ ਬੱਚਿਆਂ ਲਈ ਪ੍ਰਸ਼ਾਦਾਂ ਦਾ ਸਪਲਾਈ ਘੱਟ ਸਕਦਾ ਹੈ